ਹੈਲੋ ਸਤਿ ਸ਼੍ਰੀ ਅਕਾਲ ਜੀ ਐੱਮ ਕੇ ਬਿਲਡਰਜ਼ ਤੋਂ ਐੱਮ ਕੇ ਬੋਲ ਰਿਹਾ ਜੀ ਹਾਂਜੀ ਹਾਂਜੀ ਹੋਰ ਕਿਵੇਂ ਹੋ ਸਰ ਠੀਕ ਹੋ ਘਰ ਪਰਿਵਾਰ ਸਭ ਵਧੀਆ ਜੀ ਸਰ ਵਧੀਆ ਜੀ ਵਧੀਆ ਆਪਣੀ ਨਿਊ ਫਰਮ ਵਾਸਤੇ ਨਾ ਮੈਂ ਇੱਕ ਲੋਗੋ ਗ੍ਰਾਫਿਕ ਲੋਗੋ ਡਿਜ਼ਾਈਨ ਕਰਨਾ ਸੀ ਅਤੇ ਉਸ ਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਹਾਂਜੀ

ਦੇਖੋ ਭਾਅ ਜੀ ਮੈਂ ਇੱਦਾਂ ਚਾਹੁੰਦਾ ਹਾਂ ਕਿ ਮੇਰਾ ਲੋਗੋ ਬਹੁਤ ਵਧੀਆ ਹੋਵੇ ਔਰ ਅੱਜ ਦੀ ਨਵੀਂ ਟਕਨੀਕ ਦੇ ਨਾਲ ਬਣਿਆ ਹੋਵੇ ਅਤੇ ਇਹੋ ਜਿਹਾ ਲੋਗੋ ਮਾਰਕੀਟ ਦੇ ਵਿੱਚ ਕਿਤੇ ਨਾ ਹੋਵੇ ਕੁਛ ਅੱਜਕੱਲ੍ਹ ਨਵੀਂ ਟੈਕਨੀਕ ਕਾਫੀ ਮੇਰਾ ਜੀ ਐੱਮ ਕੇ ਬਿਲਡਰ ਦੇ ਨਾਮ ਤੋਂ ਆਪਣੀ ਫ਼ਰਮ ਹੈ ਆਪਣਾ ਬਿਲਡਰ ਹੈ ਬਿਲਡਿੰਗ ਆਪਣਾ ਕੰਸਟ੍ਰਕਸ਼ਨ ਦਾ ਕੰਮ ਹੈ ਉਸ ਰਿਗਾਰਡਿੰਗ ਆਪਾਂ ਕੁਛ ਇੱਦਾਂ ਦਾ ਲੋਗੋ ਤਿਆਰ ਕਰਨਾ ਹੈ ਕਿ ਜਿਸ ਨਾਲ ਲੋਕ ਅਟ੍ਰੈਕਟ ਹੋਣ ਅਤੇ ਆਪਣੇ ਕੰਮ ਦੇ ਵਿੱਚ ਵਾਧਾ ਪਵੇ ਅਤੇ ਮੈਨੂੰ ਤੁਸੀਂ ਇਹ ਦੱਸ ਸਕੋਂਗੇ ਕਿ ਅਸੀਂ ਤੁਹਾਨੂੰ ਲੋਗੋ ਕਦ ਤੱਕ ਤੁਸੀਂ ਤਿਆਰ ਕਰ ਦਿਉਂਗੇ ਅਤੇ ਮੈਂ ਕਦ ਆ ਕੇ ਉਹਨੂੰ ਇੱਕ ਵਾਰ ਫ਼ਾਈਨਲ ਤੋਂ ਪਹਿਲੇ ਦੇਖ ਸਕਦਾ ਹਾਂ ਅਤੇ ਮੈਨੂੰ ਸਹੀ ਸਮਾਂ ਦਾ ਤੁਸੀਂ ਦੱਸ ਦਿਉ ਕਿ ਕਿਸ ਸਮੇਂ ਮੈਂ ਤੁਹਾਡੇ ਕੋਲ ਆ ਸਕਦਾ ਹਾਂਜੀ ਪਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਲੋਗੋ ਤੁਸੀਂ ਤਿਆਰ ਕਰੋਂਗੇ ਨਾ ਕਿ ਉਹ ਜ਼ਿਆਦਾ ਮੈਨੂੰ ਉਹਦੇ ਵਿੱਚ ਇੱਦਾਂ ਦੇ ਅੱਖਰ ਨਹੀਂ ਚਾਹੀਦੇ ਕਿ ਜਿਸਦੇ ਵਿੱਚ ਲੋਕਾਂ ਨੂੰ ਪੜ੍ਹਨ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇ ਮੈਨੂੰ ਲੋਗੋ ਇੱਦਾਂ ਦਾ ਚਾਹੀਦਾ ਹੈ ਕਿ ਉਹਦੇ ਵਿੱਚ ਦੂਰੋਂ ਹੀ ਨਜ਼ਰ ਲੋਕਾਂ ਦੀ ਉਸ 'ਤੇ ਜਾਵੇ ਤਾਂ ਹੋਰ ਹੋ ਸਕੇ ਉਸ ਤੋਂ ਇਲਾਵਾ ਉਸਦੇ ਰੰਗ ਦੇ ਵਿੱਚ ਕਾਲੇ ਰੰਗ ਦੀ ਵਰਤੋਂ ਨਹੀਂ ਕੀਤੀ ਕੀਤੀ ਜਾਣੀ ਚਾਹੀਦੀ ਇਸ ਤੋਂ ਇਲਾਵਾ ਤੁਸੀਂ ਉਸਨੂੰ ਪੀਲੇ ਰੰਗ ਦਾ ਵਰਤੋਂ ਕਰ ਸਕਦੇ ਹੋ ਅਤੇ ਪੀਲਾ ਅਤੇ ਲਾਲ ਹੋਵੇ ਤਾਂ ਕਿ ਲੋਕਾਂ ਦੀ ਅੱਖ ਦੇ ਵਿੱਚ ਦੂਰੋਂ ਉਹ ਲੋਗੋ ਪੈ ਜਾਵੇਗਾ ਅਤੇ ਨਵੀਂ ਟਕਨੀਕ ਦੇ ਨਾਲ ਯੂਜ਼ ਕਰੋ ਹਾਂਜੀ ਅਤੇ ਮੈਨੂੰ ਉਸਦੀ ਮਿਲ ਕੇ ਫੇਰ ਅਸੀਂ ਉਸਦੇ ਪ੍ਰਾਈਜ਼ ਦੀ ਵੀ ਗੱਲਬਾਤ ਕਰ ਦੇਵਾਂਗੇ ਕਿ ਤੁਹਾਡਾ ਕਿ ਮੈਨੂੰ ਉਸ ਲੋਗੋ ਦਾ ਕੀ ਤੁਸੀਂ ਮੁੱਲ ਲਉਂਗੇ ਮੇਰੇ ਤੋਂ ਚਲੋ ਠੀਕ ਹੈ ਮੈਂ ਕੱਲ ਅੱਠ ਵਜੇ ਸਹੀ ਤੁਹਾਡੇ ਕੋਲ ਪਹੁੰਚਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ